ਖਿਡਾਰੀਆਂ ਦੀ ਯੋਗਤਾ ਨੂੰ ਸੁਧਾਰਨ ਲਈ ਸਰਕਾਰੀ ਖੇਡ ਮੈਦਾਨਾ ਦੇ ਮਿਆਰ ਨੂੰ ਉੱਚਾ ਕੀਤਾ ਜਾ ਰਿਹਾ ਹੈ ਜਿਸ ਨਾਲ ਸਾਰੇ ਖਿਡਾਰੀ ਜੋ ਕਿ ਖੇਡਣਾ ਚਾਹੁੰਦੇ ਹਨ ਦੇਸ਼ ਦਾ ਨਾਮ ਅੱਗੇ ਕਰ ਵਧਾਉਣਾ ਚਾਹੁੰਦੇ ਹਨ ਉਹਨਾਂ ਨੂੰ ਉਹਨਾਂ ਲਈ ਹਰ ਇੱਕ ਚੀਜ਼ ਜਿਵੇਂ ਕਿ ਉਹਨਾਂ ਦੇ ਬੈਟ ਬੋਲ ਖੇਡਣਾ ਹੈ ਕੋਈ ਹੋਕੀ ਖੇਡਣਾ ਚਾਹੁੰਦਾ ਹੈ ਕੁਸ਼ਤੀ ਕਰਨਾ ਚਾਹੁੰਦੇ ਹਾਂ ਜੋ ਵੀ ਜੋ ਜਿਹੜਾ ਵੀ ਬੰਦਾ ਜੋ ਵੀ ਖੇਡ ਖੇਡਣਾ ਚਾਹੁੰਦਾ ਹੈ ਬੈਡਮਿੰਟਨ ਆਪਣਾ ਦੇਸ਼ ਦਾ ਨਾਮ ਰੋਸ਼ਨ ਕਰਨਾ ਚਾਹੁੰਦਾ ਹੈ ਉਹ ਹਰ ਚੀਜ਼ ਕਰ ਸਕਦੇ ਹਨ ਅਤੇ ਖਿਡਾ ਖੇਡਾਂ ਦੀ ਤਿਆਰੀ ਲਈ ਸਰਕਾਰੀ ਸਹੂਲਤਾਂ ਦਾ ਲਾਭ ਲਿਆ ਜਾ ਸਕਦਾ ਹੈ ਜੋ ਵੀ ਖਿਡਾਰੀ ਖੇਡ ਖੇਡ ਕੇ ਗੋਲਡ ਮੈਡਲ ਸਿਲਵਰ ਮੈਡਲ ਲੈ ਕੇ ਆਉਣਗੇ ਉਹਨਾਂ ਨੂੰ ਸਰਕਾਰ ਦੁਆਰਾ ਰਕਮ ਮਿਲ ਦਿੱਤੀ ਜਾਂਦੀ ਹੈ ਉਹਨਾਂ ਦੀ ਸਰਕਾਰ ਬਹੁਤ ਜ਼ਿਆਦਾ ਸਹਾਇਤਾ ਕਰਦੀ ਹੈ ਅਤੇ ਜਦੋਂ ਉਹ ਸਾਰੇ ਚੀਜ਼ਾਂ ਹੁੰਦੀਆਂ ਹਨ ਅਤੇ ਨਵੇਂ ਜਵਾਨ ਵੀ ਜਵਾਕ ਮੁੰਡੇ ਵੀ ਕੁੜੀਆਂ ਵੀ ਚਾਹੁੰਦੇ ਹਨ ਕਿ ਉਹ ਵੀ ਖੇਡਾਂ ਵਿੱਚ ਆਪਣਾ ਅਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨ ਸਾਰੇ ਜਾਣੇ ਜੇ ਇੱਦਾਂ ਹੀ ਮਿਲਜੁਲ ਕਰ ਕਰਨਗੇ ਸਾਰੀਆਂ ਚੀਜ਼ਾਂ ਖੇਡਾਂ ਨੂੰ ਵਧਾਉਣਗੇ ਅੱਗੇ ਤਾਂ ਸਾਡੇ ਜਿਹੜੇ ਛੋਟੇ ਛੋਟੇ ਬੱਚੇ ਹਨ ਉਹ ਵੀ ਹੈ ਚੀਜ਼ਾਂ ਵੱਲ ਅੱਗੇ ਵਧਣਗੇ ਉਹਨਾਂ ਨੂੰ ਵੀ ਹੋਵੇਗਾ ਵੀ ਅਸੀਂ ਵੀ ਆਪਣੇ ਦੇਸ਼ ਤੋਂ ਨਾਮ ਰੋਸ਼ਨ ਕਰੀਏ ਅਤੇ ਅਸੀਂ ਵੀ ਹਰ ਇੱਕ ਚੀਜ਼ ਵੱਲ ਜਾਈਏ ਜਿੱਦਾਂ ਕਿ ਸਾਡੇ ਵੱਡੇ ਕਰਦੇ ਹਨ